ਹੈਲੋ ਨਮਸ ਨਮਸਤੇ ਹਾਂਜੀ ਹਾਂਜੀ ਦੱਸੋ ਮੈਂ ਤੁਹਾਡੀ ਕੀ ਹੈਲਪ ਕਰ ਸਕਦੀ ਹਾਂ ਹਾਂਜੀ ਹਾਂਜੀ ਸਾਡੇ ਕੋਲ ਲੇਟੈਸਟ ਪੈਕਜ ਹੈ ਨਾ ਜੋ ਦੁਬਈ ਔਰ ਥਾਈਲੈਂਡ ਦਾ ਚੱਲ ਰਿਹਾ ਤੁਸੀਂ ਦੱਸੋ ਕਿੱਥੇ ਘੁੰਮਣਾ ਚਾਹੁੰਦੇ ਹੋ ਤੁਸੀਂ ਅਸੀਂ ਦੁਬਈ ਦੀ ਪਹਿਲੇ ਮੈਂ ਤੁਹਾਨੂੰ ਦੱਸ ਦਿੰਦੀ ਦੁਬਈ ਦੀ ਸਾਡੀ ਦੋ ਲੱਖ ਦਾ ਪੈਕਜ ਹੈ ਉਹਦੇ 'ਚ ਅਸੀਂ ਤੁਹਾਨੂੰ ਏਅਰ ਟਿਕਟ ਹੋਵੇਗੀ ਸਾਡੇ ਵੱਲੋਂ ਹੋਵੇਗੀ ਜਿੱਥੇ ਤੁਸੀਂ ਘੁੰਮਣ ਆਏ ਜੇ ਰਹਿਣ ਦਾ ਖਰਚਾ ਮੀਨਿੰਗ ਕਿ ਹੋਟਲ ਵਗੈਰਾ ਜਿੱਥੇ ਵੀ ਤੁਸੀਂ ਜਾਣਾ ਜੋ ਵੀ ਟਿਕਟ ਹੋਣੀ ਹੈ ਉਹ ਸਾਡੇ ਵੱਲੋਂ ਕੀਤੀ ਜਾਊਗੇ ਤੁਹਾਡਾ ਕੋਈ ਖਰਚਾ ਨਹੀਂ ਹੋਣਾ ਇਹਦੇ ਵਿੱਚ ਅਤੇ ਥਾਈਲੈਂ ਜਿਹੜਾ ਥਾਈਲੈਂਡ ਦਾ ਏ ਉਹਦੇ ਵਿੱਚ ਡੇਢ ਲੱਖ ਦਾ ਹੋਣਾ ਏ ਕਰੰਸੀ ਦਾ ਥੋੜ੍ਹਾ ਫਰਕ ਪੈ ਜਾਂਦਾ ਏ ਨਾ ਅਤੇ ਥਾਈਲੈਂਡ ਵਿੱਚ ਜਿਹੜੇ ਬੀਚ 'ਤੇ ਤੁਹਾਨੂੰ ਮੀਨਿੰਗ ਕਿ ਉਹ ਮਿਲੂੰਗੇ ਜੋ ਵੀ ਹੋਟਲ ਵਗੈਰਾ ਏ ਉਹਦੇ ਵਿੱਚ ਜ਼ਿਆਦੇ ਕਰ ਹੋਟਲ ਸਾਡੇ ਮੇਰੇ ਫਰੈਂਡਸ ਦੇ ਹੀ ਹੈ ਉਹਦੇ ਵਿੱਚ ਤੁਹਾਨੂੰ ਸਟੇਅ ਕਰਨ ਲਈ ਰੱਖਿਆ ਜਾਏਗਾ ਓਕੇ ਤੁਸੀਂ ਸੋਚ ਕੇ ਸਾਨੂੰ ਦੱਸ ਦਿਓ ਫਿਰ ਹਾਂਜੀ ਹਾਂਜੀ ਤੁਹਾਡੇ ਵੱਲ ਦੇ ਅਸੀਂ ਕਈ ਜਣਿਆਂ ਦੇ ਵੀਜ਼ੇ ਲਗਾਏ ਹੈ ਨਾ ਤੁਸੀਂ ਆਪਣਾ ਸੋਚ ਕੇ ਫਿਰ ਦੱਸ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਕਰ ਦਾਂਗੀ ਤੁਹਾਨੂੰ ਓਕੇ ਜਦੋਂ ਮਰਜ਼ੀ ਆ ਜਿਓ ਜਦੋਂ ਤੁਹਾਡਾ ਟਾਈਮ ਲੱਗਿਆ ਤੁਸੀਂ ਆ ਸਕਦੇ ਹੋ ਓਕੇ